ਹੈਲੋ ਹਾਂਜੀ ਅਸੀਂ ਮੋਬਾਇਲ ਸ਼ੋਪ ਤੋਂ ਬੋਲ ਰਹੇ ਹਾਂ ਤੁਸੀਂ ਸਾਨੂੰ ਤੁਸੀਂ ਸਾਨੂੰ ਹਾਂਜੀ ਸਾਡੇ ਕੋਲ ਆਈਫੋਨ ਰੇਡਮੀ ਐਮ ਆਈ ਵਿਵੋ ਓਪੋ ਸੈਮਸੰਗ ਦੀ ਕੰਪਨੀ ਦੇ ਸਾਡੇ ਕੋਲ ਮੋਬਾਈਲ ਹੈਗੇ ਨੇ ਜਿਹੜੇ ਕਿ ਨਵੇਂ ਤੋਂ ਨਵੇਂ ਮਤਲਬ ਜਿਹੜਾ ਵੀ ਨਵਾਂ ਮਾਡਲ ਆਉਂਦਾ ਉਹਦੇ ਵਿੱਚ ਸਾਡੇ ਕੋਲ ਇਸ ਟਾਈਮ ਮੋਬਾਈਲ ਹੈਗੇ ਆ ਤੁਸੀਂ ਕਿਹੜਾ ਪਰਚੇਸ ਕਰਨਾ ਚਾਹੁੰਦੇ ਹੋ ਇਹਨਾਂ ਵਿੱਚੋਂ ਸਾਡੇ ਕੋਲ ਵੇਖੋ ਵੱਖਰੀ ਵੱਖਰੀ ਰੇਂਜ ਦੇ ਨੇ ਵੱਖਰੇ ਵੱਖਰੇ ਮੋਡਲ ਨੇ ਉਸ ਹਿਸਾਬ ਨਾਲ ਦਸ ਹਜ਼ਾਰ ਦਾ ਵੀ ਹੈ ਪੰਦਰ੍ਹਾਂ ਵੀਹ ਹਜ਼ਾਰ ਦਾ ਪੱਚੀ ਤੀਹ ਹਜ਼ਾਰ ਦਾ ਤੁਸੀਂ ਕਿਹੜਾ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਜ਼ਿਆਦਾ ਪੈਸੇ ਲਾਉਣੇ ਆ ਜਾਂ ਫਿਰ ਤੁਸੀਂ ਹਿਸਾਬ ਹਿਸਾਬ ਦੇ ਪੈਸੇ ਲਾਉਣੇ ਹੈ ਤੁਹਾਡੇ 'ਤੇ ਡਿਪੇਡ ਕਰਦਾ ਫਿਰ ਜੋ ਤੀਹ ਹਜ਼ਾਰ ਵਾਲਾ ਤਾਂ ਉਹਦੇ ਵਿਚ ਤੁਹਾਨੂੰ ਦੋ ਤਿੰਨ ਹਜ਼ਾਰ ਤੱਕ ਦਾ ਡਿਸਕਾਊਂਟ ਮਿਲ ਜੁਗਾ ਏਟ ਲੀਸਟ ਛੱਬੀ ਸਤਾਈ ਹਜ਼ਾਰ ਰੁਪਈਆ ਤਾਂ ਤੁਹਾਨੂੰ ਦੇਣਾ ਹੀ ਪੈਣਾ ਨਹੀਂ ਜੀ ਪੱਚੀ ਹਜ਼ਾਰ ਵਿੱਚ ਤਾਂ ਹੋਣਾ ਨਹੀਂ ਹੋ ਸਕਦਾ ਅਤੇ ਹਾਂਜੀ ਆਨਲਾਈਨ ਸੁਵਿਧਾ ਤਾਂ ਹੈਗੀ ਹੈ ਚਲੋ ਠੀਕ ਹੈ ਤੁਹਾਡਾ ਕਰ ਦੇਵਾਂਗੇ ਤੁਸੀਂ ਦੱਸੋ ਤੁਸੀਂ ਕਿੰਨੇ ਸੈਮਸੁੰਗ ਮੰਗਵਾਉਣੇ ਆ ਤੁਸੀਂ ਇੱਕ ਫੋਨ ਮੰਗਵਾਉਣਾ ਮੋਬਾਈਲ ਫੋਨ ਜਾਂ ਦੋ ਫੋਨ ਮੰਗਵਾਉਣੇ ਕਿੰਨੇ ਫੋਨ ਮੰਗਵਾਉਣਾ ਚਾਹੁੰਦੇ ਹੋ ਓਪੋ ਕੰਪਨੀ ਦੇ ਹੀ ਚਾਹੀਦੇ ਜਾਂ ਫਿਰ ਤੁਸੀਂ ਹੋਰ ਕਿਸੇ ਕੰਪਨੀ ਦਾ ਮੰਗਵਾਉਣਾ ਵੀਵੋ ਦਾ ਸੈਮਸੰਗ ਦਾ ਜਿਹੜੇ ਨਵੇਂ ਹੁਣ ਇਸ ਟਾਈਮ ਮੋਡਲ ਆਏ ਆ ਜਿਹੜੇ ਇਸ ਟਾਈਮ ਹੀ ਲੋਂਚ ਹੋਏ ਆ ਉਹ ਵਾਲਾ ਮਾਡਲ ਚਾਹੀਦਾ ਜਾਂ ਫਿਰ ਤੁਹਾਨੂੰ ਕੁਛ ਕੁਛ ਆ ਗਿਆ ਕੋਈ ਮੋਡਲ ਚਾਹੀਦਾ ਤੁਸੀਂ ਆਪਦਾ ਇਹ ਦੱਸੋ ਸਾਨੂੰ ਅੱਛਾ ਜੀ ਹਾਂਜੀ ਕੋਈ ਗੱਲ ਨਹੀਂ ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਅਤੇ ਫਿਰ ਜੇ ਅਸੀਂ ਤੁਹਾਨੂੰ ਆਨਲਾਈਨ ਮੰਗਵਾ ਕੇ ਦੇਣਾ ਫਿਰ ਸਾਡਾ ਕੰਮ ਹੋਊਗਾ ਸਾਡੀ ਸਿਰਦਰਦੀ ਹੋਊਗੀ ਜੇ ਅਸੀਂ ਉਹਨੂੰ ਕਿਵੇਂ ਆਪਾਂ ਵਾਪਸ ਭੇਜਣਾ ਜੇਕਰ ਜੋ ਵੀ ਕਰਨਾ ਤਾਂ ਕੋਈ ਗੱਲ ਨਹੀਂ ਉਹ ਸਾਡੇ ਥਰੂ ਆਉਣਾ ਫੇਰ ਇਸ ਕਰਕੇ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਅਤੇ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਦੱਸੋ ਅਤੇ ਜਿਹੜਾ ਵੀ ਫੋਨ ਚਾਹੀਦਾ ਨਹਂੀਂ ਨਹੀਂ ਡਿਲੀਵਰੀ ਦੇ ਜ਼ਿਆਦਾ ਚਾਰਜਿਸ ਪੇਅ ਨਹੀਂ ਕਰਨੇ ਪੈਣਗੇ ਕੋਈ ਗੱਲ ਨਹੀਂ ਸਾਡੀ ਇੱਥੇ ਸ਼ੋਪ ਵੀ ਹੈਗੀ ਹੈ ਤੁਸੀਂ ਉੱਧਰ ਆ ਕੇ ਵੀ ਗੱਲ ਕਰ ਸਕਦੇ ਹੋ ਆਪਾਂ ਔਨਲਾਈਨ ਸਰਵਿਸ ਕਰਦੇ ਹਾਂ ਤਾਂ ਕੋਈ ਗੱਲ ਨਹੀਂ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਵਧੀਆ ਫੋਨ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਸ ਨ ਨਵੇਂ ਮੋਡਲ ਦਾ ਵੀ ਹੋਵੇ ਅਤੇ ਤੁਹਾਡੇ ਕੋਲ ਵਧੀਆ ਵੀ ਚੱਲੇ ਤੁਹਾਡੇ ਪੈਸਿਆਂ ਦੀ ਵੀ ਬਚਤ ਹੋਵੇ ਤਾਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਜਿੰਨਾ ਤੁਸੀਂ ਕਹਿ ਦਿੱਤਾ ਡਿਸਕਾਊਂਟ ਤੁਹਾਡਾ ਮੰਨ ਲੈਂਦੇ ਹਾਂ ਤੁਹਾਨੂੰ ਓਨੇ ਦੇ ਹਿਸਾਬ ਨਾਲ ਫੋਨ ਮਿਲ ਜਾਊਗਾ ਅਤੇ ਥੋੜ੍ਹੇ ਟਾਈਮ ਲੱਗੇਗਾ ਵੇਟ ਕਰ ਲਓ ਓਕੇ ਜੀ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਦੱਸੋਗੇ ਅਸੀਂ ਤੁਹਾਡਾ ਫੋਨ ਤੁਹਾਨੂੰ ਥੋੜ੍ਹੇ ਦਿਨਾਂ ਤੱਕ ਜਦੋਂ ਵੀ ਆਊਗਾ ਤੁਹਾਨੂੰ ਅਸੀਂ ਮੇਸ਼ੈਜ਼ ਕਰ ਦੇਵਾਂਗੇ ਅਤੇ ਤੁਹਾਡੇ ਘਰ ਤੱਕ ਵੀ ਪਹੁੰਚ ਜਾਊਗਾ ਹਾਂਜੀ ਓਕੇ ਜੀ